ਪੰਜਾਬ ਦਾ ਵਪਾਰ ਨਵੀਨਤਾ ਅਤੇ ਤੈਕਨੋਲਜੀ ਨੂੰ ਵਧਾਵਾ ਦੇ ਰਿਹਾ ਹੈ ਨਵੇ ਆਈਡੋਲਜੀ ਤੈਕਨੋਲੋਜੀ ਅਤੇ ਉਤਪਾਦਕਾ ਅਤੇ ਨਾਲ ਬਹੁਤ ਸਾਰੇ ਸਟਾਰਟਅਪ ਅਤੇ ਉਦਯੋਗ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ ਇਹ ਵਿਕਾਸ ਕਈ ਹਨ ਜਿੱਦਾਂ ਕਿ ਨਵੀਂ ਟੈਕਨੋਲਜੀ ਹੋ ਗਈ ਜਿਹਦੇ ਵਿੱਚ ਅਸੀਂ ਕੰਪਿ ਕੰਪਿਊਟਰ ਕਰੰਸੀ ਜਾਂ ਏ ਆਏ ਅਤੇ ਡਿਜੀਟਲ ਮਾਰਕਟਿੰਗ ਜਿਵੇਂ ਨਵੇਂ ਖੇਤਰ ਵਧ ਰਹੇ ਹਨ ਨਵੇਂ ਖੇਤਰ ਵੱਧ ਰਹੇ ਹਨ ਸਰਕਾਰੀ ਹੁਣ ਅਗਲਾ ਹੈਗਾ ਸਰਕਾਰੀ ਮਦਦ ਜਿਹਦੇ ਵਿੱਚ ਸਟਾਰਟਅਪ ਪੰਜਾਬ ਐਮ ਐਸ ਐਮ ਈ ਯੋਜਨਾ ਵਰਗੀਆਂ ਯੋਜਨਾਵਾਂ ਨਵੇਂ ਵਪਾਰਾਂ ਦੀ ਮਦਦ ਕਰ ਰਹੀਆਂ ਹਨ ਅਤੇ ਅਗਲਾ ਆਈ ਟੀ ਪਾਕਸ ਦੇ ਨਵੇਂ ਉਦਯੋਗ ਵਿੱਚ ਵੀ ਮੁਹਾਲੀ ਆਈ ਟੀ ਪਾਰਕ ਚੰਡੀਗੜ੍ਹ ਇਨੋਵੇਸ਼ਨ ਹਨ ਨਵੇਂ ਸਟਾਰਟਅਪ 'ਚ ਤੁਸੀਂ ਦੇਖਿਆ ਹੀ ਹੋਣਾ ਕਿ ਕ ਇਹ ਵਧੀਆ ਮੌਕੇ ਦੇ ਰਹੇ ਹਨ ਇਹਦੇ ਵਿੱਚ ਕਈ ਸਾਰੇ ਨਵੇਂ ਵਾਪ ਵਪਾਰਿਕ ਆਮ ਤਰੀਕੇ ਨਾਲ ਕਿਹਾ ਜਾਂਦਾ ਹੈ ਜਿਹਦੇ ਵਿੱਚ ਸਾਡੇ ਵਿੱਚ ਆ ਜਾਂਦਾ ਹੈ ਈਕਮਰਸ਼ ਜਿਹਦੇ ਵਿੱਚ ਅਸੀਂ ਆਨਲਾਈਨ ਸਟੋਰ ਵਿੱਚ ਇੱਕ ਪੰਜਾਬੀ ਪ੍ਰੋਡਕਸ ਬਣਾ ਕੇ ਉਹਨੂੰ ਅਸੀਂ ਡਿਜੀਟਲ ਸਰਵਿਸ ਨੂੰ ਵਿ ਵਪਾਰਕਾਂ ਨੂੰ ਦੇ ਸਕ ਦੇ ਸਕਦੇ ਹਨ ਅਤੇ ਉਹਨੂੰ ਵ ਵੱਧ ਰਹੇ ਅੱਜ ਕੱਲ੍ਹ ਦੇ ਅੱਜ ਕੱਲ੍ਹ ਦੇ ਸਟੋਰਸ ਅਤੇ ਹੈਂਡਮੇਡ ਪ੍ਰੋਡਕਟਸ ਨੂੰ ਅਸੀਂ ਵਧਾ ਸਕਦੇ ਹਨ ਅਤੇ ਅਗਲਾ ਇੱਕ ਸਮਾਰਟ ਅਲਜਿਸਟਿਕਸ ਜਿਹਦੇ ਵਿੱਚ ਏ ਆਈ ਬੇਸ ਇਨਵੈਂਟਰੀ ਆ ਜਾਂਦੀ ਹੈ ਡਰੋਨ ਡਿਲੀਵਰੀ ਆ ਜਾਂਦੀ ਹੈ ਅਤੇ ਡਿਜੀਟਲ ਵਿਅਰਊਸਿੰਗ ਆ ਜਾਂਦੀ ਹੈ ਜਿਹਦੇ ਵਿੱਚ ਨਾਲ ਕੰਮ ਤੋਂ ਸ਼ੋ ਸ਼ੋੜਿਆ ਹੈ ਅਤੇ ਅਗਲੇ ਵਿੱਚ ਕੋਵਰਕੀ ਪੋਲਿਸਿਸ ਆ ਜਾਂਦੇ ਹਨ ਪਰੋਡਕਟਿਵਲੀ ਟੂਲ ਆ ਜਾਂ ਜਿੱਦਾਂ ਮੈਂ ਜਿੱਦਾਂ ਟਰੈਲੋ ਨੌਸ਼ਨ ਵਰਗੀ ਐਪਸ ਕਈ ਸਾਰੇ ਕੰਮ ਨੂੰ ਆਸਾਨ ਕਰ ਦਿੰਦੇ ਹਨ ਅਤੇ ਸਾਨੂੰ ਟਾਈਮ ਮੈਨੇਜਮੈਂਟ ਦਾ ਇੱਕ ਸਹੀ ਤਰੀਕਾ ਦੇਖਣ ਨੂੰ ਮਿਲਦਾ ਹੈ ਇਹ ਸਾਰੀਆਂ ਨਤੀਜੇ ਵਪਾਰ ਅਤੇ ਨਵਾਪਣ ਟੈਕਨੋਲੋਜੀ ਅਤੇ ਸਕਿਲ ਡਿਵੈਲਪਮੈਂਟ ਦੇ ਨਾਲ ਨਵੇਂ ਮੌਕੇ ਬਣ ਰਹੇ ਹਨ ਡਿਜੀਟਲ ਇਨੋਵੇਸ਼ਨ ਈਕਮਰਸ ਅਤੇ ਏ ਆਈ ਬਾਏ ਸਲਿਊਸ਼ਨ ਵਪਾਰ ਨੂੰ ਨਵੀ ਦਿਸ਼ਾ ਦੇ ਰਹੇ ਹਨ ਧੰਨਵਾਦ ਸਾਹਿਤ